ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਡਮ ਅਤੇ ਆਪਣਾ ਨਾ ਮਾਰਕੀਟ 'ਚ ਹੀ ਡੋਕਟਰ ਵੀ ਹੈਗਾ ਜੇ ਤੁਸੀਂ ਜਾ ਕੇ ਦਿਖਾਉਣਾ ਚਾਹੋ ਉੱਥੇ ਵੀ ਜਾ ਸਕਦੇ ਹੋ ਜੇ ਤੁਸੀਂ ਆਪਣਾ ਔਨਲਾਈਨ ਮੰਗਵਾਉਣੀ ਤਾਂ ਆਪਣੇ ਕੋਲ ਇੱਥੇ ਅਭੁੱਲ ਫਾਰਮੈਸੀ ਹੈਗੀ ਆ ਮੈਂ ਤੁਹਾਨੂੰ ਉਹਨਾ ਦਾ ਕੋਂਟੈਕਟ ਨੰਬਰ ਭੇਜ ਦਿੰਦਾ ਉਹ ਘਰ ਵੀ ਡਿਲੀਵਰ ਕਰ ਦਿੰਦਾ ਇੱਕ ਛੋਟੀ ਜਿਹੀ ਇੱਥੇ ਆਪਣੇ ਦੁਕਾਨ ਵੀ ਹੈਗੀ ਉਹ ਵੀ ਘਰ ਭੇਜ ਦਿੰਦਾ ਦਵਾਈਆਂ ਅਤੇ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਤੁਸੀਂ ਇੱਕ ਵਾਰੀ ਗੱਲ ਕਰਲੋ ਜੋ ਜੇ ਕੋਈ ਦਵਾਈ ਮੰਗਵਾਉਣੀ ਹੈ ਤਾਂ ਘਰ ਵੀ ਆ ਜਾਵੇਗੀ ਠੀਕ ਹੈ ਜੀ ਠੀਕ ਹੈ ਜੀ